ਹੈਲੋ ਨਮਸਕਾਰ ਸਰ ਮੈਂ ਸਰ ਸ ਤੁਸੀਂ ਗੁਰੂ ਕਿਰਪਾ ਫਾਜ਼ਿਲਕਾ ਤੋਂ ਬੋਲ ਰਹੇ ਹੋ ਸਟੇਸ਼ਨਰੀ ਸ਼ੋਪ ਤੋਂ ਸਰ ਸਾਨੂੰ ਨਾ ਸਟੇਸ਼ਨਰੀ ਤਾਂ ਕੁਝ ਸਮਾਨ ਚਾਹੀਦਾ ਸੀਗਾ ਹਾਂ ਸਾਨੂੰ ਕੁਝ ਫੋਟੋਸਟੇਟ ਦੇ ਚਾਹੀਦੇ ਸੀ ਪੈਕਟ ਪੇਜਸ ਦੇ ਹਾਂਜੀ ਏ ਫੋਰ ਹਾਂਜੀ ਅਤੇ ਕੁਝ ਕਲਾਸਮੈਟ ਦੀਆਂ ਕਾਪੀਜ ਚਾਹੀਦੀਆਂ ਸੀ ਵੀਹ ਕੁ ਸੈੱਟ ਚਾਹੀਦੇ ਸੀਗੇ ਏ ਫੋਰ ਪੇਜਸ ਨਹੀਂ ਮੈਂ ਸਰ ਕੋਪੀਸ ਚਾਹੀਦੀਆਂ ਆਰ ਦਸ ਤੋਂ ਵੀਹ ਸੈੱਟ ਹੋ ਜਾਣਾ ਵੀਹ ਸੈਟ ਕਰ ਦਿਓ ਹਾਂਜੀ ਅਤੇ ਹੋਰ ਚਾਹੀਦੇ ਸੀ ਪੈਨ ਚਾਹੀਦੇ ਆ ਬਟਰ ਫਲੋ ਵਾਲੇ ਹਾਂਜੀ ਉਹ ਫਿਫਟੀ ਅ ਪੰਜਾਹ ਕੁ ਪੀਸ ਦੇ ਦਿਓ ਨੋਟ ਕਰ ਲਓ ਤੁਸੀਂ ਹਾਂ ਬਾਕੀ ਚਾਹੀਦੀਆਂ ਸੀ ਨਟਰਾਜ ਦੀ ਪੈਨਸਿਲਸ ਮਿਲ ਜਾਣਗੀਆਂ ਹਾਂਜੀ ਨਟਰਾਜ ਦੀ ਪੈਨਸਿਲਸ ਦੇ ਵੀ ਕਰ ਦਿਓ ਵੀਹ ਕੁ ਪੀਸ ਕਰ ਦਿਓ ਉਹ ਵੀ ਹਾਂਜੀ ਅਤੇ ਕਲਰ ਪੈਨਸਿਲਸ ਉਹਦੇ ਦਸ ਸੈਟ ਕਰ ਦਿਓ ਹਾਂਜੀ ਅਤੇ ਇਹ ਸਮਾਨ ਕਦੋਂ ਕੁ ਤੱਕ ਸਰ ਮਿਲ ਜਾਏਗਾ ਸਾਨੂੰ ਪਿੰਡ 'ਚ ਭਜਾਉਣਾ ਸਾਡੇ ਇੱਥੇ ਫਾਜ਼ਿਲਕਾ ਦੇ ਲਾਗੇ ਨੇੜੇ ਪਿੰਡ ਆ ਸਰ ਜਲਦੀ ਹੋ ਸਕੇ ਤੇ ਪਹੁੰਚਾ ਦਿਓ ਕਿਉਂ ਸਾਡੇ ਸਮਾਨ ਇੱਥੇ ਖ਼ਤਮ ਹੋ ਰੱਖਿਆ ਠੀਕ ਹੈ ਸਰ ਕੋਈ ਚੱਕਰ ਨਹੀਂ ਕੱਲ੍ਹ ਤੱਕ ਪਹੁੰਚਾ ਲਿਓ ਹੋਰ ਚਾਹੀਦੇ ਸੀਗੇ ਇਰੇਜ਼ਰ ਇਰੇਜ਼ਰਾਂ ਦਾ ਇੱਕ ਡੱਬਾ ਦੇ ਦਿਓ ਉਹਦੇ 'ਚ ਕਿੰਨੇ ਪੀਸ ਹੁੰਦੇ ਆ ਹਾਂ ਪੰਦਰਾਂ ਵਾਲੇ ਦੋ ਪੀਸ ਕਰ ਦਿਓ ਦੋ ਡੱਬੇ ਕਰ ਦਿਓ ਹਾਂਜੀ ਹਾਂ ਨਟਰਾਜ ਦੇ ਹੀ ਦੇ ਦਿਓ ਹਾਂਜੀ ਹਾਂਜੀ ਕਲਰ ਸਕੈਚ ਵੀ ਕਰ ਦਿਓ ਕੁਝ ਉਹ ਦਸ ਡੱਬੇ ਉਹ ਕਰ ਦਿਓ ਹਾਂਜੀ ਠੀਕ ਹੈ ਸਰ ਹਾਂਜੀ ਸਰ ਸਰ ਇੱਕ ਉਹ ਵੀ ਚਾਹੀਦਾ ਸੀਗਾ ਅਸਾਈਨਮੈਂਟ ਸ਼ੀਟਸ ਹਾਂਜੀ ਡਿਜ਼ਾਇਨਰ ਪੀਸ ਕਰਦਿਆ ਜੇ ਦਸ ਕੁ ਸੈੱਟ ਕਰ ਦਿਓ ਜੀ ਠੀਕ ਹੈ ਸਰ ਬਸ ਇੰਨਾ ਹੀ ਕਰਨਾ ਸੀਗਾ ਮੈਂ ਵਾ ਮੈਸੇਜ ਕਰ ਦਾਂਗੀ ਤੁਹਾਨੂੰ ਠੀਕ ਹੈ ਥੈਂਕ ਯੂ ਸਰ